ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਪਛਾਣਿਆ ਨੀ ਤੁਹਾਡੇ ਤੁਹਾਡੇ ਗੁਆਂਢ ਵਿੱਚ ਤਿੰਨ ਚਾਰ ਦਿਨ ਹੋ ਗਏ ਪਹਿਲਾਂ ਆਏ ਸੀ

ਹਾਂਜੀ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਹੋਰ ਘਰੇ ਠੀਕ ਹੈ ਸਭ ਹਾਂਜੀ ਵਧੀਆ ਮੈਂ ਤੁਹਾਨੂੰ ਤਾਂ ਕੋਲ ਕੀਤੀ ਸੀ ਇੱਥੇ ਤੁਹਾਡੇ ਤਾਜ਼ੀਆਂ ਸਬਜ਼ੀਆਂ ਵਗੈਰਾ ਦੀ ਕੋਈ ਮੰਡੀ ਮੁੰਡੀ ਹਾਂਜੀ ਅੱਛਾ ਜੀ ਅੱਛਾ ਜੀ ਹਾਂਜੀ ਸਬਜ਼ੀਆਂ ਖ਼ਰੀਦ ਕੇ ਲਿਆਂਣੀਆਂ ਸੀ ਮੈਂ ਕਿਹਾ ਚਲੋ ਇਹਨਾਂ ਨੂੰ ਤਾਂ ਪਤਾ ਤੁਸੀਂ ਪੁਰਾਣੇ ਇੱਥੇ ਦੇ ਰਹਿੰਦੇ ਆਂ ਹਾਂਜੀ ਹੋਰ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਵਧੀਆ ਕੋਆਲਟੀ ਦੀ ਹੋਣੀ ਚਾਹੀਦੀ ਖ਼ਰਾਬ ਵਗੈਰਾ ਨੀ ਨਾ ਹੋਵੇ ਵੈਸੇ ਕਿਹੜੀ ਕਿਹੜੀ ਸਬਜ਼ੀ ਹੁੰਦੀ ਇੱਥੇ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਖ਼ਰੀਦਣੀਆਂ ਉੱਥੋ ਹੀ ਖ਼ਰੀਦ ਕੇ ਲਿਆਂਦੀ ਆਂ ਚਲੋ ਠੀਕ ਹੈ ਫਿਰ ਓਕੇ ਜੀ